ਪੰਜਾਬ ਦੇ ਇਤਿਹਾਸ ਵਿੱਚ ਕੁਝ ਅਜਿਹੀਆਂ ਲਹਿਰਾਂ ਹੋਈਆਂ ਜਿਸ ਨਾਲ ਸੱਭਿਆਚਾਰ ਇੱਕ ਸਮਾਜਿਕ ਅਤੇ ਹੋਰ ਕਾਫੀ ਲਹਿਰਾਂ ਨੇ ਪੰਜਾਬ ਦੇ ਰੂਪ ਨੂੰ ਇਤਿਹਾਸਿਕ ਰੂਪ ਦਿੱਤਾ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਹੋਈ ਜਿਸ ਵਿੱਚ ਇੱਕ ਮਜ਼ਬੂਤ ਸਿੱਖ ਰਾਜ ਦੀ ਸਥਾਪਨਾ ਹੋਈ ਅੰਗਰੇਜ਼ੀ ਹਕੂਮਤ ਪੰਜਾਬ ਅੰਗਰੇਜ਼ੀ ਹਕੂਮਤ ਦੇ ਅਧੀਨ ਰਿਹਾ ਇਸ ਲਹਿਰ ਦੇ ਅਧੀਨ ਕਈ ਨਵੇਂ ਖੇਤੀਬਾੜੀ ਦੇ ਨਵੇਂ ਤਰੀਕੇ ਵੀ ਅਪਣਾਏ ਗਏ ਇਸ ਤੋਂ ਬਾਅਦ ਭਗਤ ਸਿੰਘ ਅਤੇ ਆਜ਼ਾਦੀ ਦੀ ਲਹਿਰ ਭਗਤ ਸਿੰਘ ਅਤੇ ਹੋਰ ਕਈ ਕ੍ਰਾਂਤੀਕਾਰੀ ਕ੍ਰਾਂਤੀਕਾਰੀਆਂ ਨੇ ਭਾਰਤ ਦੀ ਆਜ਼ਾਦੀ ਲਈ ਇੱਕ ਅਲੱ ਅਲੱਗ ਵਿਲੱਖਣ ਮੁਹਿਮ ਵੀ ਚਲਾਈ ਜਿਸ ਨਾਲ ਸਮਾਜਿਕ ਜਾਗਰੂਕਤਾ ਵਧੀ ਬਟਵਾਰਾ ਅਤੇ ਪਾਰਟੀਸ਼ਨ ਹੋਇਆ ਜਿਸ ਦੌਰਾਨ ਉੱਨੀ ਸੋ ਸੰਤਾਲੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਬਟਵਾਰੇ ਵਿੱਚ ਵੀ ਵੰਡਿਆ ਗਿਆ ਇਸ ਨਾਲ ਵੱਡਾ ਮਨੁੱਖੀ ਸੰਗਰਾਮ ਪੈਦਾ ਹੋਇਆ ਹਰੀ ਕ੍ਰਾਂਤੀ ਦੀ ਲਹਿਰ ਉੱਨੀ ਸੌ ਸੱਠ ਦੇ ਦਹਾਕੇ ਦੇ ਲਗਭਗ ਦੌਰਾਨ ਹਰੀ ਕ੍ਰਾਂਤੀ ਪੰਜਾਬ ਦੇ ਖੇਤੀਬਾੜੀ ਅਤੇ ਹੋਰ ਕਾਫੀ ਬਦਲਾਅ ਪੈਦਾ ਹੋਇਆ ਇਸ ਨਾਲ ਖੇਤਰ ਦੇ ਅਨਾਜ ਦੀ ਪੈਦਾਵਾਰ ਅੱਗੇ ਬਹੁਤ ਵਾਧਾ ਹੋਇਆ ਪੰਜਾਬੀ ਸੰਗੀਤ ਅਤੇ ਸਿਨੇਮਾ ਦੀ ਲਹਿਰ ਇਸ ਸਮੇਂ ਸਾਡੇ ਪੰਜਾਬ ਦੇ ਸੰਗੀਤ ਅਤੇ ਸਿਨੇਮਾ ਦੇ ਵਿੱਚ ਵੀ ਬਹੁਤ ਯੋਗਦਾਨ ਰਿਹਾ ਅੰਗਰੇਜ਼ੀ ਹਕੂਮਤ ਲਹਿਰ ਇਹ ਹਕੂਮਤ ਲਹਿਰ ਲਗਭਗ ਅਠਾਰ੍ਹਾਂ ਸੌ ਉਣੰਜਾ ਦੇ ਵਿੱਚ ਆਈ ਇਸ ਸਮੇਂ ਪੰਜਾਬ ਦੇ ਕਈ ਸਿੱਖ ਧਰਮ ਖੇਤੀਬਾੜੀ ਪ੍ਰਥਮਾ ਸਿੱਖਿਆ ਪ੍ਰਣਾਲੀ ਵਿੱਚ ਵਾਧਾ ਹੋਇਆ ਭਗਤ ਸਿੰਘ ਅਤੇ ਆਜ਼ਾਦੀ ਦੀ ਲਹਿਰ ਪੰਜਾਬ ਦੇ ਕਈ ਸਪੂਤਾਂ ਜਿਵੇਂ ਕਿ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਬਹੁਤ ਹੀ ਜ਼ਿਆਦਾ ਯੋਗਦਾਨ ਪਾਇਆ ਇਸ ਵਿੱਚ ਇਸ ਲਹਿਰ ਦੇ ਵਿੱਚ ਕਈ ਹੋਰ ਸੂਰਬੀਰ ਯੋਧੇ ਵੀ ਸ਼ਾਮਿਲ ਹਨ ਮਹਾਰਾਜਾ ਰਣਜੀਤ ਸਿੰਘ ਦੀ ਲਹਿਰ ਸਮੇਂ ਪੰਜਾਬ ਇੱਕ ਅਜਿਹਾ ਸੂਬਾ ਬਣਿਆ ਜੋ ਕਿ ਲਗਭਗ ਪੂਰੇ ਪੰਜਾਬ ਦੇ ਵਾਸੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਇਆ ਇਸ ਦੌਰਾਨ ਪੰਜਾਬ ਦੇ ਜੋ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਰਹਿ ਰਹੇ ਲੋਕ ਬਹੁਤ ਖੁਸ਼ ਸਨ ਕਿਉਂਕਿ ਇਹ ਰਾਜ ਬਹੁਤ ਹੀ ਨਿਰਪੱਖ ਸੀ ਇਸ ਵਿੱਚ ਹਾਂ ਆਮ ਗਰੀਬ ਅਤੇ ਹਰੇਕ ਇਨਸਾਨ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਅੰਗਰੇਜ਼ੀ ਹਕੂਮਤ ਦੇ ਸਮੇਂ ਆਪਣੇ ਪੰਜਾਬੀ ਸੱਭਿਆਚਾਰ ਅਤੇ ਖੇਤੀਬਾੜੀ ਦਾ ਬਹੁਤ ਵਿਕਾਸ ਹੋਇਆ ਹਰੀ ਕ੍ਰਾਂਤੀ ਦੇ ਸਮੇਂ ਸਾਨੂੰ ਆਪਣੀਆਂ ਫਸਲਾਂ ਦਾ ਮੁੱਲ ਪੈਦਾ ਹੋਇਆ ਜੋ ਕਿ ਅਬ ਬਹੁਤ ਹੀ ਕਿਸਾਨ ਭਰਾਵਾਂ ਲਈ ਲਾਹੇਵੰਦ ਰਿਹਾ ਧੰਨਵਾਦ ਸਹਿਤ